ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਜੀ ਕਿਆ ਹਾਲ ਚਾਲ ਹੈ ਜੀ ਹੋਰ ਸਭ ਵਧੀਆ ਜੀ ਮੈਂ ਭਾਅ ਜੀ ਪੰਦਰਾਂ ਵੀਹ ਦਿਨ ਪਹਿਲਾਂ ਤੁਹਾਡੇ ਤੋਂ ਬੁੱਕਸ ਆਰਡਰ ਕੀਤੀਆਂ ਸੀਗੀਆਂ ਰਾਕੇਸ਼ ਜਰਆਵ ਸਰ ਦੀਆਂ ਇੱਕ ਤਾਂ ਉਨ੍ਹਾਂ ਦੀ ਸੀਗੀ ਕਲਾਸ ਨੋਟਸ ਔਫ ਮੈਥੇਮੈਟਿਕਸ ਅਤੇ ਦੂਜੀ ਉਹਨਾਂ ਦੀ ਜੀ ਕੇ ਸੀਗੀ ਲੇਟੈਸਟ ਪੈਟਰਨ ਵਾਲੀ ਅਤੇ ਉਹਦੇ ਵਿੱਚ ਜਿਹੜੀ ਉਹਦੀ ਪੈਕੇਜਿੰਗ ਕੁਆਲਿਟੀ ਸੀਗੀ ਉਹ ਵੀ ਕਾਫੀ ਅੱਛੀ ਸੀਗੀ ਜਿਹੜਾ ਉਹਦੇ ਬੁੱਕ ਦਾ ਰੰਗ ਢੰਗ ਸੀਗਾ ਉਹ ਭਾਅ ਜੀ ਬਹੁਤ ਵਧੀਆ ਸੀਗਾ ਓਹਦਾ ਜਿਹੜੀਆਂ ਹੋਰ ਕਿਤਾਬਾਂ ਮੈਂ ਲਈਆਂ ਸੀਗੀਆਂ ਬਜ਼ਾਰੋਂ ਉਹਦੇ ਨਾਲੋਂ ਕਾਫ਼ੀ ਇਮਪਰੈਸਿਵ ਸੀਗਾ ਭਾਅ ਜੀ ਉਹ ਉਹਦੇ ਵਿੱਚ ਜਿਹੜੀਆਂ ਜੋ ਵੀ ਉਹਦਾ ਸਿਲੇਬਸ ਸੀਗਾ ਉਹ ਪੂਰਾ ਐਗਜਾ ਐਗਜਾਮ ਨਾਲ ਸੰਬੰਧਿਤ ਸੀਗਾ ਓਹਨੂੰ ਪੜ੍ਹਕੇ ਭਾਅ ਜੀ ਮੈਂ ਆਪਣਾ ਐਗਜਾਮ ਕਲੀਅਰ ਕਰ ਸਕਿਆ ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਅ ਜੀ